ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਕ੍ਰਿਸ਼ਨ ਭੰਡਾਰ ਤੋਂ ਬੋਲਦੇ ਜੀ ਬਰਤਨ ਭੰਡਾਰ ਤੋਂ ਹਾਂਜੀ ਅਸੀਂ ਨਾ ਤੁਹਾਡੀ ਦੁਕਾਨ ਬਾਰੇ ਸੁਣਿਆ ਸੀਗਾ ਅਤੇ ਵੀ ਵਧੀਆ ਕੁਆਲਿਟੀ ਦੇ ਬਰਤਨ ਮਿਲਦੇ ਇੱਥੋਂ ਹਾਂਜੀ ਅਤੇ ਉਹ ਸਾਡੇ ਘਰ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਹਾਂਜੀ ਅਤੇ ਸਾਨੂੰ ਵੱਡੇ ਬਰਤਨ ਚਾਹੀਦੇ ਜੀ ਕੜਾਹੀਆਂ ਪਰਾਤਾਂ ਅਤੇ ਹਾਂਜੀ ਨਹੀਂ ਜੀ ਅਸੀਂ ਪਿੱਤਲ ਦੇ ਲੈਣੇ ਹੈ ਪਿੱਤਲ ਦੀ ਦੇਗ ਕੜ੍ਹਾਹੀ ਅਤੇ ਪਿੱਤਲ ਦੀ ਪਰਾਤ ਹਾਂਜੀ ਅਤੇ ਸਾਨੂੰ ਤੁਸੀਂ ਆਪਦੇ ਪਿੱਤਲ ਦਾ ਦੱਸ ਦਿਓ ਵੀ ਕਿਸ ਹਿਸਾਬ ਦਾ ਚੱਲ ਰਿਹਾ ਹੈਗਾ ਅੱਜ ਕੱਲ੍ਹ ਹਾਂਜੀ ਹਾਂਜੀ ਠੀਕ ਹੈ ਜੀ ਫੇਰ ਹਾਂਜੀ ਕੱਲ੍ਹ ਫੇਰ ਅਸੀਂ ਪਤਾ ਕਰ ਲਵਾਂਗੇ ਆ ਜਾਂਗੇ ਅਤੇ ਹਾਂਜੀ ਅਤੇ ਤੁਸੀਂ ਆਪਦਾ ਵਧੀਆ ਭਾਂਡੇ ਸਾਨੂੰ ਦਿਖਾ ਦਿਓ ਅਤੇ ਫੇਰ ਅਸੀਂ ਲੈ ਕੇ ਜਾਵਾਂਗੇ ਇੱਕ ਦੋ ਦੁਕਾਨਾਂ 'ਤੇ ਅਸੀਂ ਪਹਿਲਾਂ ਪਤਾ ਕਰ ਚੁੱਕੇ ਹੋਏ ਹਾਂ ਫੇਰ ਅਸੀਂ ਸਾਨੂੰ ਦੱਸਿਆ ਵੀ ਕਿਸੇ ਨੇ ਵੀ ਇੱਥੋਂ ਮਿਲਣਗੇ ਵਧੀਆ ਇਸ ਕਰਕੇ ਫੇਰ ਸਾਨੂੰ ਹਾਂਜੀ ਹੋਰ ਹਾਂਜੀ ਅਤੇ ਫੇਰ ਕੱਲ੍ਹ ਕਿੰਨੇ ਵਜੇ ਸ਼ੋਪ ਖੁਲ੍ਹੇਗੀ ਜੀ ਤੁਹਾਡੀ ਠੀਕ ਹੈ ਜੀ ਦਸ ਵਜੇ ਠੀਕ ਹੈ ਜੀ ਅਸੀਂ ਬਾਰ੍ਹਾਂ ਕੁ ਵਜੇ ਪਹੁੰਚ ਜਾਵਾਂਗੇ ਅਤੇ ਫੇਰ ਲੈ ਜਾਵਾਂਗੇ ਠੀਕ ਹੈ ਠੀਕ ਹੈ ਜੀ ਓਕੇ ਓਕੇ ਜੀ ਠੀਕ ਹੈ